ਮੇਰੀ ਅਤੇ ਮੇਰੇ ਬੱਚਿਆਂ ਦੀ ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਸੀ ਇਸ ਲਈ ਮੈਂ ਅਤੇ ਮੇਰੇ ਸਾਰੇ ਪਰਿਵਾਰ ਨੇ ਮਿਲ ਕੇ ਕਿਤੇ ਘੁੰਮਣ ਜਾਣ ਬਾਰੇ ਸੋਚਿਆ ਤਾਂ ਫਿਰ ਅਸੀਂ ਢਿੱਲੋਂ ਫਨ ਵਰਲਡ ਪਟਿਆਲੇ ਜਾਣ ਬਾਰੇ ਸੋਚਿਆ ਇਸ ਲਈ ਮੈਂ ਰਾਤ ਨੂੰ ਅਗਲੇ ਦਿਨ ਜਾਣ ਲਈ ਊਬਰ ਵੈੱਬਸਾਈਟ ਤੋਂ ਇੱਕ ਗੱਡੀ ਬੁੱਕ ਕਰਵਾਈ ਜਿਸ ਜੋ ਜਦੋਂ ਸਵੇਰੇ ਊਬਰ ਵਾਲਾ ਆਇਆ ਊਬਰ ਵਾਲੀ ਗੱਡੀ ਆਈ ਤਾਂ ਅਸੀਂ ਸਾਰੇ ਮੈਂ ਮੇਰੀ ਘਰਵਾਲੀ ਮੇਰੇ ਦੋ ਬੱਚੇ ਇੱਕ ਮੁੰਡਾ ਅਤੇ ਕੁੜੀ ਅਸੀਂ ਸਾਰੇ ਉਸ ਦੀ ਗੱਡੀ ਵਿਚ ਚਲੇ ਗਏ ਅਸੀਂ ਘੁੰਮਦੇ ਹੋਏ ਪੂਰੇ ਮਜ਼ੇ ਕਰਦੇ ਹੋਏ ਪਟਿਆਲੇ ਗਏ ਅਤੇ ਫਨ ਵਰਲਡ ਵਿਚ ਜਾ ਕੇ ਕਾਫੀ ਮਜ਼ੇ ਕੀਤੇ ਜਿਸ ਵਿਚ ਜਿਸ ਰਾਹੀਂ ਰਾਤ ਹੌਲੀ ਹੌਲੀ ਸ਼ਾਮ ਦੇ ਪੰਜ ਵੱਜ ਗਏ ਅਤੇ ਜਦੋਂ ਅਸੀਂ ਵਾਪਸ ਆਉਣ ਲੱਗੇ ਤਾਂ ਫਿਰ ਪਟਿਆਲੇ ਵਿਚ ਮੇਰੀ ਮਾਸੀ ਰਹਿੰਦੀ ਸੀ ਤਾਂ ਫਿਰ ਅਸੀਂ ਊਬਰ ਵਾਲੇ ਡਰਾਈਵਰ ਨੂੰ ਕਿਹਾ ਕਿ ਸਾਡੀ ਮਾਸੀ ਉੱਥੇ ਰਹਿੰਦੀ ਹੈ ਤਾਂ ਸਾਨੂੰ ਉੱਥੇ ਵੀ ਲੈ ਜਾਵੇ ਤਾਂ ਫਿਰ ਡਰਾਈਵਰ ਸਾਨੂੰ ਮੇਰੀ ਮਾਸੀ ਕੋਲ ਲੈ ਗਿਆ ਅਸੀਂ ਮਾਸੀ ਕੋਲ ਕਾਫ਼ੀ ਦੇਰ ਤੱਕ ਰੁਕੇ ਅਤੇ ਕਾਫੀ ਗੱਲਾਂ ਕੀਤੀਆਂ ਇਸ ਇਸ ਵਿਚ ਕਾਫ਼ੀ ਰਾਤ ਹੋ ਗਈ ਅਤੇ ਅਸੀਂ ਰਾਤ ਦੇ ਦਸ ਵਜੇ ਤੋਂ ਉੱਥੇ ਤੋਂ ਤੁਰੇ ਅਤੇ ਜਦੋਂ ਘਰ ਪਹੁੰਚੇ ਤਾਂ ਊਬਰ ਵਾਲਾ ਊਬਰ ਵਾਲੇ ਨੇ ਮੇਰੇ ਤੋਂ ਪੈਸੇ ਮੰਗੇ ਜਿਸ ਦਾ ਬਿੱਲ ਦਸ ਹਜ਼ਾਰ ਹੋ ਗਿਆ ਸੀ ਅਤੇ ਊਬਰ ਵਾਲਾ ਡਰਾਈਵਰ ਕਹਿੰਦਾ ਕਿ ਮੈਂ ਉਸ ਨੂੰ ਔਨਲਾਈਨ ਪੇਮੈਂਟ ਕਰ ਦੇਵਾਂ ਪਰੰਤੂ ਨੈੱਟਵਰਕ ਦੀ ਸਮੱਸਿਆ ਕਾਰਨ ਔਨਲਾਈਨ ਪੈਸੇ ਨਹੀਂ ਜਾ ਰਹੇ ਸਨ ਇਸ ਲਈ ਮੈਂ ਉਸ ਨੂੰ ਨਕਦ ਪੈਸੇ ਦੇਣ ਲੱਗਿਆ ਅਤੇ ਉਸ ਨੇ ਨਕਦ ਪੈਸੇ ਮੇਰੇ ਤੋਂ ਲੈ ਲਏ ਮੈਂ ਉਸ ਨੂੰ ਪੂਰੇ ਦਸ ਹਜ਼ਾਰ ਰੁਪਏ ਨਕਦ ਦੇ ਦਿੱਤੇ